ਯੋਗਾ ਜੋ ਹੈ ਉਹ ਸਿਰਫ਼ ਇੱਕ ਕਸਰਤ ਦਾ ਰੂਪ ਹੀ ਨਹੀਂ ਬਟ ਇੱਕ ਇਨਸਾਨ ਦੀ ਜੋ ਹੈ ਉਹ ਓਵਰਔਲ ਬੌਡੀ ਡਿਵਲਪਮੈਂਟ ਲਈ ਵੀ ਇੱਕ ਬਹੁਤ ਵਧੀਆ ਚੀਜ਼ ਹੈ ਇੰਡੀਆਂ ਦੇ ਵਿੱਚ ਪੁਰਾਣੇ ਸਮੇਂ ਤੋਂ ਹੀ ਲੋਕ ਯੋਗਾ ਕਰਦੇ ਨੇ ਇਸ ਲਈ ਇਸ ਇੰਡੀਆ ਦੇ ਲੋਕ ਜੋ ਨੇ ਉਹ ਬਹੁਤ ਹੀ ਤੰਦਰੁਸਤ ਮੰਨੇ ਜਾਂਦੇ ਨੇ ਪਹਿਲਾਂ ਯੋਗਾ ਬਾਰੇ ਇੰਡੀਆ ਤੋਂ ਬਾਹਰ ਦੇ ਲੋਕਾਂ ਨੂੰ ਜ਼ਿਆਦਾ ਜਾਣਕਾਰੀ ਨਹੀਂ ਸੀ ਬਟ ਹੁਣ ਕ ਜਿਵੇਂ ਕਿ ਇੱਕੀ ਜੂਨ ਹਰ ਸਾਲ ਇੱਕੀ ਜੂਨ ਨੂੰ ਯੋਗਾ ਡੇ ਵੀ ਮਨਾਇਆ ਜਾਂਦਾ ਹੈ ਜਿਸ ਨਾਲ ਯੋਗਾ ਨੂੰ ਪ੍ਰਮੋਟ ਕੀਤਾ ਜਾਂਦਾ ਹੈ ਅਤੇ ਇੰਟਰਨੈਸ਼ਨਲੀ ਵੀ ਯੋਗਾ ਜੋ ਹੈ ਉਹ ਪ੍ਰਮੋਟ ਕੀਤਾ ਜਾਂਦਾ ਹੈ ਇੰਟਰਨੈਸ਼ਨਲੀ ਵੀ ਡੋਕਟਰਸ ਨੇ ਇਹ ਕਿਹਾ ਹੈ ਕਿ ਬਹੁਤ ਸਾਰੀਆਂ ਇਹੋ ਜਿਹੀਆਂ ਬਿਮਾਰੀਆਂ ਨੇ ਜਿਸ ਦਾ ਯੋਗਾ ਦੇ ਨਾਲ ਹੱਲ ਕੀਤਾ ਜਾ ਸਕਦਾ ਹੈ ਇੰਡੀਆ ਦੇ ਵਿੱਚ ਬਾਬਾ ਰਾਮਦੇਵ ਨੇ ਯੋਗਾ ਨੂੰ ਬਹੁਤ ਹੀ ਪ੍ਰਮੋਟ ਕੀਤਾ ਹੈ ਅਤੇ ਲੋਕਾਂ ਨੂੰ ਇਹ ਸੁਝਾਵ ਦਿੱਤਾ ਹੈ ਕਿ ਆਪਣੀ ਡੇਲੀ ਰੁਟੀਨ ਦੇ ਵਿੱਚ ਸਵੇਰੇ ਉੱਠ ਕੇ ਅੱਧਾ ਘੰਟਾ ਜਾਂ ਫਿਰ ਕੁਛ ਸਮੇਂ ਯੋਗਾ ਕਰਨਾ ਚਾਹੀਦਾ ਹੈ ਜਿਸ ਨਾਲ ਪੂਰਾ ਦਿਨ ਜੋ ਹੈ ਉਹ ਵਧੀਆ ਨਿਕਲੇ ਅਤੇ ਇਨਸਾਨ ਜੋ ਹੈ ਉਹ ਸਵੱਸਥ ਰਵੇ ਹਰੇਕ ਇਨਸਾਨ ਨੂੰ ਆਪਣੇ ਰੋਜ਼ਾਨਾ ਜ਼ਿੰਦਗੀ ਵਿੱਚ ਕੁਛ ਯੋਗਾ ਆਸਣ ਜੋ ਨੇ ਉਹ ਕਰਨੇ ਚਾਹੀਦੇ ਨੇ ਜਿਸ ਨਾਲ ਉਸ ਦਾ ਸਰੀਰ ਜੋ ਹੈ ਉਹ ਤੰਦਰੁਸਤ ਰਵੇ